ਭਾਰਤ ਦੇ ਵਿੱਚ ਸਭ ਤੋਂ ਵੱਡੇ ਯੋਗ ਗੁਰੂ ਬਾਬਾ ਰਾਮਦੇਵ ਜੀ ਉਹਨਾਂ ਨੇ ਸਾਰੇ ਭਾਰਤ ਦੇ ਵਿੱਚ ਯੋਗਾ ਮੁਹਿੰਮ ਚਲਾਈ ਉਹਨਾਂ ਨੇ ਬਹੁਤ ਹੀ ਲੋਕਾਂ ਨੂੰ ਰੋਗਮੁਕਤ ਕੀਤਾ ਥਾਂ ਥਾਂ 'ਤੇ ਯੋਗ ਕਲਾਸਾਂ ਸਟਾਰਟ ਕਰਵਾਈਆਂ ਉਹ ਖੁਦ ਵੀ ਟੈਲੀਵਿਜ਼ਨ ਤੋਂ ਪ੍ਰੋਗਰਾਮ ਨੂੰ ਸਟਾਰਟ ਕੀਤਾ ਯੋਗਾ ਦਾ ਤਾਂ ਕਿ ਲੋਕ ਉਸ ਤੋਂ ਲਾਭ ਉਠਾ ਸਕਣ ਬਹੁਤ ਲੋਕਾਂ ਨੇ ਤਾਂ ਉਹਨਾਂ ਦੀਆਂ ਟੈਲੀਵਿਜ਼ਨ 'ਤੇ ਯੋਗ ਕਲਾਸਾਂ ਦੇਖ ਕੇ ਵੀ ਯੋਗ ਆਪਣੇ ਘਰ ਕੀਤੇ ਉਹ ਉਹਨਾਂ ਨੂੰ ਹੀ ਅਸੀਂ ਸਭ ਤੋਂ ਵੱਡੇ ਗੁਰੂ ਮੰਨਦੇ ਆਂਗੇ ਯੋਗਾ ਦੇ ਕਿਉਂਕਿ ਉਹਨਾਂ ਨੇ ਸਿਖਾਇਆ ਸਾਰੇ ਭਾਰਤ ਨੂੰ ਵੀ ਯੋਗ ਕੀ ਚੀਜ਼ ਹੈ ਠੀਕ ਹੈ ਇਸ ਕਰਕੇ ਅਸੀਂ ਬਾਬਾ ਰਾਮਦੇਵ ਜੀ ਨੂੰ ਹੀ ਮੰਨਾਂਗੇ ਵੀ ਉਹ ਸਭ ਤੋਂ ਵਧੀਆ ਯੋਗ ਗੁਰੂ ਨੇ ਠੀਕ ਆ ਉਹਨਾਂ ਤੋਂ ਅਸੀਂ ਪ੍ਰਭਾਵਿਤ ਐਵੇਂ ਹੁੰਦੇ ਹਾਂ ਕਿਉਂਕਿ ਉਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਦੇਖ ਕੇ ਐਂ ਲੱਗਦਾ ਵੀ ਬਹੁਤ ਹੀ ਛੋਟੀ ਉਮਰ ਆ ਉਹਦਾ ਕਾਰਨ ਕੀ ਹੈ ਕਿਉਂਕਿ ਉਹ ਆਪਣੇ ਸਰੀਰ ਨੂੰ ਯੋਗ ਕਰ ਕਰ ਕੇ ਉਹਨਾਂ ਨੇ ਇੰਨਾ ਸਡੋਲ ਬਣਾਇਆ ਹੋਇਆ ਵੀ ਉਹਨਾਂ ਦੀ ਉਮਰ ਵੀ ਓਨੀ ਦਿਖਾਈ ਨਹੀਂ ਦਿੰਦੀ ਉਹਨਾਂ ਤੋਂ ਸਾਨੂੰ ਐਵੇਂ ਪ੍ਰਭਾਵਿਤ ਹੋਣਾ ਚਾਹੀਦਾ ਵੀ ਜੇ ਆਪਾਂ ਸਾਰੇ ਜਣੇ ਯੋਗ ਕਰੀਏ ਤਾਂ ਤੁਸੀਂ ਸੋਚੋ ਵੀ ਕਿੰਨੀ ਵਧੀਆ ਸਿਹਤ ਰਹੂਗੀ ਕਿੰਨੇ ਸਡੋਲ ਸਰੀਰ ਹੋਣਗੇ ਆਪਣੇ ਅਤੇ ਆਪਾਂ ਨੂੰ ਕੋਈ ਵੀ ਬਿਮਾਰੀ ਨਹੀਂ ਲੱਗੂਗੀ ਜਿਹੜੇ ਲੋਕ ਹੁਣ ਹਾਰਟ ਅਟੈਕ ਨਾਲ ਮਰ ਜਾਂਦੇ ਨੇ ਕੈਂਸਰ ਨਾਲ ਮਰ ਜਾਂਦੇ ਨੇ ਠੀਕ ਹੈ ਉਹਦਾ ਕਾਰਨ ਇਹ ਹੀ ਹੈ ਵੀ ਆਪਾਂ ਖਾਈ ਤਾਂ ਜਾਂਦੇ ਹਾਂ ਅਤੇ ਸਰੀਰ ਨੂੰ ਹਿਲਾਉਂਦੇ ਬਿਲਕੁਲ ਵੀ ਨਹੀਂ ਅਤੇ ਬਾਬਾ ਜੀ ਵੀ ਇਹ ਹੀ ਗੱਲ ਕਹਿੰਦੇ ਨੇ ਵੀ ਤੁਸੀਂ ਯੋਗ ਕਰੋ ਯੋਗ ਦੇ ਨਾਲ ਕੀ ਹੋਵੇਗਾ ਜਿਹੜਾ ਤੁਹਾਡਾ ਸਰੀਰ ਹੈ ਉਹ ਫੁਰਤੀ 'ਚ ਰਹਿੰਦਾ ਹੈਗਾ ਅਤੇ ਤੁਸੀਂ ਦੇਖਣ ਦੇ ਵਿੱਚ ਬੁੱਢੇ ਨਹੀਂ ਲੱਗੋਂਗੇ ਬਸ ਵੱਡੀ ਗੱਲ ਇਹਨਾਂ ਦੀ ਇਹ ਹੀ ਹੈ ਵੀ ਅਸੀਂ ਉਹਨਾਂ ਤੋਂ ਐਵੇਂ ਹੀ ਪ੍ਰਭਾਵਿਤ ਹੁੰਦੇ ਹਾਂ ਵੀ ਆਪਾਂ ਉਹਨਾਂ ਨੂੰ ਦੇਖੋ ਵੀ ਉਹਨਾਂ ਨੇ ਆਪਣੇ ਸਰੀਰ ਨੂੰ ਯੋਗ ਕਰਕੇ ਕਿੰਨਾ ਵਧੀਆ ਬਣਾਇਆ ਗਾ ਅਤੇ ਕੋਈ ਵੀ ਬਿਮਾਰੀ ਨਹੀਂ ਹੈਗੀ ਉਹਦਾ ਕਾਰਨ ਕੀ ਹੈ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਯੋਗ ਨੂੰ ਸ਼ਾਮਲ ਕੀਤਾ ਗਾ